ਮੈਨੂੰ ਬਾਗਬਾਨੀ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ ਮੈਨੂੰ ਐਵੇਂ ਲੱਗਦਾ ਹੈ ਕਿ ਪੌਦਿਆਂ ਵਿੱਚ ਵੀ ਸਾਡੇ ਹੀ ਤਰ੍ਹਾਂ ਜਾਨ ਹੁੰਦੀ ਹੈ ਮੈਨੂੰ ਉਹਨਾਂ ਦੀ ਦੇਖਭਾਲ ਕਰਨੀ ਉਹਨਾਂ ਦੀ ਸੰਭਾਲ ਕਰਨੀ ਬਹੁਤ ਹੀ ਜ਼ਿਆਦਾ ਚੰਗੀ ਲੱਗਦੀ ਹੈ ਮੈਂ ਘਰ ਵਿੱਚ ਬਹੁਤ ਸਾਰੇ ਫੁੱਲ ਲਗਾਏ ਹੋਏ ਹਨ ਜਿਵੇਂ ਗੁਲਾਬ ਦਾ ਫੁੱਲ ਗੈਂਦੇ ਦਾ ਫੁੱਲ ਲੀਲੀ ਦਾ ਫੁੱਲ ਮਾਲਤੀ ਇਹ ਸਾਰੇ ਫੁੱਲਾਂ ਤੋਂ ਬਹੁਤ ਸੋਹਣੇ ਕਲਰ ਦੇ ਫੁੱਲ ਲੱਗਦੇ ਹਨ ਅਤੇ ਮੈਂ ਬਹੁਤ ਸਾਰੇ ਜਿਵੇਂ ਫਲਾਂ ਦੇ ਪੌਦੇ ਅੰਬ ਦਾ ਪੇੜ ਅਮਰੂਦ ਚੀਕੂ ਅਨਾਰ ਇਹ ਸਭ ਲਗਾਏ ਹੋਏ ਹਨ ਅਤੇ ਇਹਨਾਂ ਤੋਂ ਮੈਨੂੰ ਫਰੈਸ਼ ਫਲ ਮਿਲਦੇ ਹਨ ਅਤੇ ਬਹੁਤ ਸਾਰੀਆਂ ਸਬਜ਼ੀਆਂ ਵੀ ਲਗਾਈਆਂ ਹੋਈਆਂ ਹਨ ਜਿਵੇਂ ਕਿ ਕਰੇਲੇ ਧਨੀਆ ਮਿਰਚਾਂ ਬੈਂਗਣੀ ਭਿੰਡੀ ਇਹਨਾਂ ਸਭ ਦੀ ਤਾਂ ਗੱਲ ਕਰਨੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਜਦੋਂ ਕਦੀ ਮੈਂ ਘਰ ਨਹੀਂ ਹੁੰਦੀ ਹਾਂ ਤਾਂ ਇਹਨਾਂ ਸਭ ਦੀ ਦੇਖਭਾਲ ਮੇਰੇ ਪਿਤਾ ਜੀ ਕਰਦੇ ਹਨ ਉਹਨਾਂ ਨੂੰ ਵੀ ਮੇਰੇ ਤਰ੍ਹਾਂ ਬਾਗਬਾਨੀ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ ਉਹ ਵੀ ਇਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਨ ਇਹਨਾਂ ਨੂੰ ਪਾਣੀ ਦੇਣਾ ਸਵੇਰੇ ਉੱਠ ਕੇ ਇਹਨਾਂ ਦੀ ਕਟਾਈ ਕਰਨੀ ਗੁਡਾਈ ਕਰਨੀ ਸਮੇਂ ਸਮੇਂ 'ਤੇ ਖਾਦ ਪਾਉਣੀ ਅਤੇ ਇਹਨਾਂ ਨੂੰ ਜਦੋਂ ਇਹ ਵੱਡੇ ਹੁੰਦੇ ਹੈ ਤਾਂ ਇਹ ਸਾਨੂੰ ਬਹੁਤ ਸਾਰੀਆਂ ਸਬਜ਼ੀਆਂ ਫਲ ਦਿੰਦੇ ਹਨ ਜਿਨ੍ਹਾਂ ਨਾਲ਼ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਸੁਖਾਲੀ ਹੋ ਜਾਂਦੀ ਹੈ